ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਮੈਂ ਤੁਹਾਨੂੰ ਇਹੀ ਦੱਸੂਗੀ ਕਿ ਇੱਥੇ ਕਦੀ ਵੀ ਟਾਈਮ 'ਤੇ ਕਦੀ ਵੀ ਗਰਮੀ ਹੋ ਜਾਂਦੀ ਹੈ ਤਾਂ ਆਪਣੇ ਬੈਗ ਵਿੱਚ ਦੋਵੇਂ ਤਰ੍ਹਾਂ ਦੇ ਕੱਪੜੇ ਰੱਖੋ ਆਪਣੀ ਤਿਆਰੀ ਪੂਰੀ ਰੱਖੋ ਆਪਣਾ ਸਾਰਾ ਸਮਾਨ ਸੈੱਟ ਰੱਖੋ ਤਾਂ ਕਿ ਮੌਸਮ ਦੇ ਬਦਲਣ 'ਚ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ

ਟਾਈਮ ਦੇ ਹਿਸਾਬ ਨਾਲ ਰੱਖ ਲਓ ਤਾਂ ਕਿ ਜਦੋਂ ਕੋਈ ਮੌਸਮ 'ਚ ਬਦਲਾਅ ਆਵੇ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ ਓਕੇ ਬਾਏ